ਅਸੀਂ ਨਾ ਦੋ ਹਜ਼ਾਰ ਇੱਕੀ 'ਚ ਦੋ ਹਜ਼ਾਰ ਇੱਕੀ 'ਚ ਵੋਚ ਮੰਗਾਈ ਤੀ ਬੋਡ ਕੰਪਨੀ ਦੀ ਮੰਨ ਲਓ ਪਹਿਲਾਂ ਤਾਂ ਗੱਲਾਂ ਸੁਣੀਆਂ ਵੀ ਵੀ ਔਨਲਾਇਨ ਵੀ ਜਿਹੜਾ ਪ੍ਰੋਡਕਟ ਮੰਗਾਉਂਦੇ ਹਾਂ ਵੀ ਕਈ ਵਾਰ ਖਰਾਬੀ ਨਿਕਲ ਜਾਂਦੀ ਕਈ ਕੁਝ ਹੋਰ ਨਿਕਲ ਜਾਂਦਾ ਪਰ ਜਿਹੜੀ ਅਸੀਂ ਵੋਚ ਮੰਗਾਈ ਤੀ ਨਾ ਬੜੀ ਹੀ ਸੋਹਣੀ ਨਿਕਲੀ ਅਤੇ ਚੱਲ ਵੀ ਐਨ ਵਧੀਆ ਕੁਆਲਿਟੀ 'ਚ ਰਹੀ ਹੈ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਉਹ 'ਚ ਅਤੇ ਦੇਖ ਲਓ ਵੀ ਦੋ ਸਾਲ ਹੋ ਗਏ ਉਹਨੂੰ ਤੀਆ ਤੀਆ ਲੱਗ ਜਾਣਾ ਅਗਲੇ ਸਾਲ ਅਤੇ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਆਈ ਬੈਟਰੀ ਬੈਕਅਪ ਕੰਟਰੋਲਰ ਬਲਿਊਟੁੱਥ ਸਭ ਕੁਝ ਐਨ ਓਕੇ ਚੱਲ ਰਿਹਾ ਅਤੇ ਸੰਭਾਲ ਦੀ ਵੀ ਬਾਕੀ ਜ਼ਰੂਰਤ ਹੁੰਦੀ ਹੈ ਵੀ ਕਿਹੜੇ ਹੱਥਾਂ 'ਚ ਚੀਜ਼ ਸੰਭਲਦੀ ਆ ਅਤੇ ਸੰਭਾਲ ਵੀ ਪੂਰੀ ਹੈ ਅਤੇ ਪ੍ਰੋਡਕਟ 'ਚ ਕੋਈ ਮਤਲਬ ਖਰਾਬੀ ਨਹੀਂ ਆਈ ਹੈਗੀ ਹਜੇ ਤੱਕ ਮਤਲਬ ਲੋਕ ਜਿਵੇਂ ਕਹਿਣ ਲੱਗ ਜਾਂਦੇ ਆ ਵੀ ਔਨਲਾਈਨ ਸਮਾਨ ਖਰੀਦਣਾ ਹੀ ਨਹੀਂ ਚਾਹੀਦਾ ਮਤਲਬ ਕਈ ਵਾਰ ਔਫਰ ਚੱਲਦੇ ਹੁੰਦੇ ਆ ਵਧੀਆ ਤਾਂ ਮੰਗਵਾ ਵੀ ਲੈਣੀ ਚਾਹੀਦੀ ਆ ਇੱਦਾਂ ਦੀ ਕੋਈ ਗੱਲ ਨਹੀਂ ਵੀ ਖਰਾਬ ਨਿਕਲਦਾ ਸਾਰੇ ਬਹੁਤ ਵਧੀਆ ਚੱਲ ਰਿਹਾ ਬੋਡ ਕੰਪਨੀ ਦਾ